ਪੰਜਾਬ ਵਿੱਚ ਜਨਸੰਖਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਕਿਉਂਕਿ ਬਾਹਰ ਦੇ ਯੂ ਪੀ ਬਿਹਾਰ ਬੰਗਲਾਦੇਸ਼ੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਪ੍ਰਭਾਵ ਬਹੁਤ ਜ਼ਿਆਦਾ ਪੈ ਰਿਹਾ ਲੁਧਿਆਣਾ ਸਿਟੀ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਮਜ਼ਦੂਰ ਹੈ ਕਿਉਂਕਿ ਉੱਥੇ ਕੰਮਕਾਰ ਦੀ ਘੱਟ ਹੈ ਇੱਥੇ ਕੰਮਕਾਰ ਆਰਾਮ ਨਾਲ ਮਿਲ ਜਾਂਦਾ ਅਤੇ ਆਬਾਦੀ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਜਿੰਨੇ ਵੀ ਪ੍ਰਵਾਸੀ ਆ ਸਾਰੇ ਪੰਜਾਬ ਦੇ ਵਿੱਚ ਆ ਰਹੇ ਹਨ